ਡਿਜੀਟਲ ਪੇਂਟਿੰਗ ਸਾਡੇ ਜੀਵਨ ਵਿੱਚ ਬਹੁਤ ਸਾਰਾ ਕੰਮ ਲੈ ਕੇ ਆਉਂਦੀ ਹੈ ਡਿਜੀਟਲ ਪੇਂਟਿੰਗ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਇਸ ਲਈ ਬਹੁਤ ਸਾਰੇ ਟੂਲ ਸੋਫਟਵੇਅਰ ਅਤੇ ਕਈ ਤਰ੍ਹਾਂ ਦੇ ਸਮਾਨ ਦੀ ਲੋੜ ਪੈਂਦੀ ਹੈ ਜਿਵੇਂ ਕਿ ਲੈਪਟਾਪ ਕੰਪਿਊਟਰ ਸਮਾਰਟਫੋਨ ਹੁੰਦੇ ਹਨ ਉਸ ਵਿੱਚ ਕਈ ਤਰ੍ਹਾਂ ਦੇ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਵੇਂ ਕਿ ਇਸ ਵਿੱਚ ਦੱਸਿਆ ਜਾਂਦਾ ਹੈ ਕਿ ਕਿਹੜੇ ਬਰਸ਼ ਟੂਲਸ ਐਂਡ ਅਤੇ ਕੀ ਕਲਰ ਕੋਂਬੀਨੇਸ਼ਨ ਅਤੇ ਉਸ ਵਿੱਚ ਬਹੁਤ ਸਾਰਾ ਬਣਾਉਣ ਲਈ ਕੋਈ ਵੀ ਚੀਜ਼ ਬਣਾਉਣ ਲਈ ਅਸੀਂ ਡਿਜ਼ਾਇਨ ਕੀਤਾ ਜਾਂਦਾ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੇ ਡਿਜੀਟਲ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਕਿ ਲੈਪਟੋਪ ਕੰਪਿਊਟਰ ਸਮਾਰਟਫੋਨ ਇਸ ਵਿੱਚ ਕੋਈ ਕਲਾ ਸੋਚਿਆ ਜਾਂਦਾ ਹੈ ਉਸ ਕਲਾ ਨੂੰ ਅਸੀਂ ਪ੍ਰਦਰਸ਼ਨ ਕਰਦੇ ਹਾਂ ਉਸ ਨੂੰ ਡਿਜਾਇਨਿੰਗ ਕਰਦੇ ਹਾਂ ਅਤੇ ਇਸ ਨੂੰ ਪੇਂਟਿੰਗ ਦੇ ਰੂਪ ਵਿੱਚ ਇੱਕ ਤਰ੍ਹਾਂ ਦਾ ਸਮਾਨ ਲੈ ਕੇ ਆਉਂਦੇ ਹਾਂ ਸੋ ਕਈ ਤਰ੍ਹਾਂ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਸ ਨੂੰ ਬਣਾਉਣਾ ਕੋਈ ਸੌਖਾ ਨਹੀਂ ਹੈ ਇਸ ਨੂੰ ਬਣਾਉਣ ਲਈ ਬਹੁਤ ਸਾਰਾ ਟਾਈਮ ਲੱਗਦਾ ਹੈ